ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਔਰ ਇੱਥੋਂ ਦੇ ਲੋਕ ਗੀਤ ਬਹੁਤ ਹੀ ਜ਼ਿਆਦਾ ਪ੍ਰਚਲਿਤ ਹਨ ਹਰ ਖੁਸ਼ੀ ਦੇ ਮੌਕੇ 'ਤੇ ਲੋਕ ਗੀਤ ਗਾਏ ਜਾਂਦੇ ਹਨ ਜਿਵੇਂ ਕਿ ਘੋੜੀਆਂ ਸੁਹਾਗ ਸਿੱਠਣੀਆਂ ਛੰਦ ਪਰਾਗਾਂ ਜਨਮ ਗੀਤ ਛੱਲਾ ਟੱਪੇ ਬੋਲੀਆਂ ਲੋਰੀਆਂ ਲੋਹੜੀ ਦੇ ਗੀਤ ਕਿੱਕਲੀ ਥਾਲ ਅਤੇ ਹੁੱਲਾ ਹੁਲਾਰੇ ਵਰਗੇ ਲੋਕ ਗੀਤ ਬਹੁਤ ਹੀ ਜ਼ਿਆਦਾ ਪ੍ਰਚਲਿਤ ਹਨ ਪੰਜਾਬ ਵਿੱਚ ਮੁੰਡੇ ਦੇ ਵਿਆਹ ਵਿੱਚ ਘੋੜੀਆਂ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਕੁੜੀ ਦੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਹਨ ਅਤੇ ਕਿਸੇ ਦੇ ਜਨਮ ਦਿਨ ਦੇ ਮੌਕੇ 'ਤੇ ਜਨਮ ਗੀਤ ਗਾਏ ਜਾਂਦੇ ਹਨ ਕੋਈ ਵੀ ਤਿਉਹਾਰ ਜਾਂ ਫੰਕਸ਼ਨ ਆਦਿ ਦੇ ਮੌਕੇ 'ਤੇ ਕੁੜੀਆਂ ਬੋਲੀਆਂ ਪਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਅਤੇ ਭੰਗੜਾ ਇੱਥੋਂ ਦਾ ਬਹੁਤ ਹੀ ਲੋਕ ਪਿਆਰਾ ਨਾਚ ਹੈ ਲੋਹੜੀ ਦੇ ਖੁਸ਼ੀ ਦੇ ਮੌਕੇ 'ਤੇ ਲੋਹੜੀ ਦੇ ਗੀਤ ਗਾਏ ਜਾਂਦੇ ਹਨ ਛੋਟੇ ਛੋਟੇ ਬੱਚੇ ਦੂਜਿਆਂ ਦੇ ਘਰਾਂ ਵਿੱਚ ਲੋਹੜੀ ਮੰਗਣ ਜਾਂਦੇ ਹਨ ਅਤੇ ਉੱਥੇ ਜਾ ਕੇ ਲੋਹੜੀ ਦਾ ਗੀਤ ਗਾਉਂਦੇ ਹਨ ਕੁੜੀਆਂ ਤੀਆਂ ਦੇ ਮੌਕਿਆਂ 'ਤੇ ਕਿੱਕਲੀ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ ਇਹ ਸਾਰੇ ਲੋਕ ਗੀਤ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਪ੍ਰਚਲਿਤ ਹਨ ਧੰਨਵਾਦ